ਸਿੱਖਿਆ ਕਿਸੇ ਵੀ ਦੇਸ਼ ਦੇ ਵਿਕਾਸ ਦੀ ਮੂਲ ਲੋੜ ਹੈ ਸਿੱਖਿਆ ਕਿਸੇ ਵੀ ਦੇਸ਼ ਦਾ ਮੁੱਖ ਥੰਮ ਹੈ ਸਿੱਖਿਆ ਦੇ ਖੇਤਰ ਵਿੱਚ ਆਈ ਤਬਦੀਲੀ ਅਤੇ ਸਿੱਖਿਆ ਦੇ ਖੇਤਰ ਵਿੱਚ ਹੋਇਆ ਵਿਕਾਸ ਕਿਸੇ ਦੇਸ਼ ਦੇ ਵਿਕਾਸ ਦਾ ਕਾਰਨ ਬਣਦਾ ਹੈ ਅੱਜ ਕੱਲ੍ਹ ਸਕੂਲਾਂ ਵਿੱਚ ਪੰਜਾਬੀ ਹਿੰਦੀ ਗਣਿਤ ਵਿਗਿਆਨ ਸਮਾਜਿਕ ਵਿਗਿਆਨ ਕੰਪਿਊਟਰ ਅਤੇ ਸਰੀਰਕ ਸਿੱਖਿਆ ਦੇ ਨਾਲ ਹੋਰ ਵਿਸ਼ੇ ਜੋ ਕਿ ਵਿਦਿਆਰਥੀ ਦੀ ਰੁਚੀ 'ਤੇ ਨਿਰਭਰ ਹੁੰਦੇ ਹਨ ਪੜ੍ਹਾਏ ਜਾਂਦੇ ਹਨ ਅੱਜ ਕੱਲ੍ਹ ਸਕੂਲਾਂ ਵਿੱਚ ਬੀ ਐੱਡ ਟੀਚਰਾਂ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ ਜੋ ਕਿ ਦਰਸਾਉਂਦਾ ਹੈ ਕਿ ਅੱਜ ਕੱਲ੍ਹ ਸਕੂਲਾਂ ਵਿੱਚ ਅਧਿਆਪਕ ਪੜ੍ਹੇ ਲਿਖੇ ਅਤੇ ਸਮਾਜਿਕ ਤੌਰ 'ਤੇ ਨਿਪੁੰਨ ਹਨ ਉਹਨਾਂ ਨੂੰ ਹਰੇਕ ਖੇਤਰ ਬਾਰੇ ਵਧੀਆ ਜਾਣਕਾਰੀ ਹੈ ਅਤੇ ਉਹਨਾਂ ਦੇ ਹੱਥਾਂ ਵਿੱਚ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੈ